ਭੰਗੜਾ ਪੰਜਾਬੀਆਂ ਦਾ ਮੁੱਖ ਨਾਚ ਹੈ ਭੰਗੜੇ ਆਪਾਂ ਨੂੰ ਵਿਆਹ ਸ਼ਾਦੀ 'ਤੇ ਵੀ ਪਾਏ ਜਾਂਦੇ ਹੈ ਜਨਮ ਦਿਨ 'ਤੇ ਵੀ ਪਾਏ ਜਾਂਦੇ ਹਨ ਇਸ ਕਰਕੇ ਭੰਗੜੇ ਦਾ ਬਹੁਤ ਮਹੱਤਵਪੂਰਣ ਹੁੰਦਾ ਹੈ ਇਸ ਕਰਕੇ ਭੰਗੜਾ ਜਿਵੇਂ ਕਿ ਚਾਦਰੇ ਤੁਰਲੇ ਵਾਲੀ ਪੱਗ ਨੋਕ ਵਾਲੀ ਜੁੱਤੀ ਪਾ ਕੇ ਮੁੰਡੇ ਪੱਗਾਂ ਬੰਨ ਕੇ ਭੰਗੜਾ ਪਾਉਂਦੇ ਹਨ ਇਸ ਕਰਕੇ ਭੰਗੜਾ ਜਨਮ ਦਿਨਾਂ 'ਤੇ ਵੀ ਪਾਇਆ ਜਾਂਦਾ ਹੈ ਲੋਹੜੀ 'ਤੇ ਵੀ ਭੰਗੜਾ ਪਾਇਆ ਜਾਂਦਾ ਹੈ ਵਿਆਹ ਸ਼ਾਦੀਆਂ 'ਚ ਵੀ ਭੰਗੜਾ ਪਾਇਆ ਜਾਂਦਾ ਹੈ ਭੰਗੜਾ ਦਾ ਬਹੁਤ ਪੰਜਾਬ ਵਿੱਚ ਮਹੱਤਤਾ ਹੈ ਇਸ ਕਰਕੇ ਭੰਗੜੇ ਦਾ ਨਾਚ ਬਹੁਤ ਹੀ ਸੋਹਣਾ ਲੱਗਦਾ ਹੈ ਭੰਗੜਾ ਪੰਜਾਬੀਆਂ ਦਾ ਪੰਜਾਬੀਆਂ ਦਾ ਮੁੱਖ ਨਾਚ ਹੁੰਦਾ ਹੈ ਭੰਗੜੇ ਦਾ ਪੰਜਾਬ ਵਿੱਚ ਬਹੁਤ ਹੀ ਜ਼ਿਆਦਾ ਲੋਹੜੀ ਮੇਲੇ ਵਿੱਚ ਪਾਇਆ ਜਾਂ ਮੇਲਿਆਂ ਵਿੱਚ ਪਾਇਆ ਜਾਂਦਾ ਹੈ ਵਿਸਾਖੀ ਵੇਲੇ ਭੰਗੜਾ ਪਾਇਆ ਜਾਂਦਾ ਹੈ ਵਿਸਾਖੀ ਬਹੁਤ ਭੰਗੜੇ ਨਾਲ ਹੀ ਮਨਾਈ ਜਾਂਦੀ ਹੈ ਇਸ ਕਰਕੇ ਭੰਗੜੇ ਦਾ ਸਭ ਤੋਂ ਪਹਿਲਾਂ ਵੱਧ ਹੁੰਦਾ ਹੈ ਇਸ ਕਰਕੇ ਭੰਗੜਾ ਬਹੁਤ ਹੀ ਮੁੰਡੇ ਪਾਉਂਦੇ ਹਨ ਹੁਣ ਬਹੁਤ ਹੀ ਭੰਗੜਾ ਪੰਜਾਬ ਵਿੱਚ ਪੂਰਾ ਸ਼ੁੱਧ ਮੰਨਿਆ ਜਾਂਦਾ ਹੈ ਵਿਸਾਖੀ ਜਿਵੇਂ ਕਿ ਵਿਸਾਖੀ ਲੋਹੜੀ ਹੋਲੀ 'ਤੇ ਵੀ ਭੰਗੜਾ ਪਾਇਆ ਜਾਂਦਾ ਹੈ ਇਹ ਸਾਰੇ ਤਿਉਹਾਰਾਂ ਵਿੱਚ ਭੰਗੜਾ ਹੀ ਪਾਇਆ ਜਾਂਦਾ ਹੈ ਭੰਗੜੇ ਦਾ ਬਹੁਤ ਪੰਜਾਬ ਵਿੱਚ ਬਹੁਤ ਰੌਣਕ ਮੇਲਾ ਹੁੰਦਾ ਹੈ ਭੰਗੜਾ ਹਰ ਇੱਕ ਥਾਂ 'ਤੇ ਭੰਗੜਾ ਵਿਆਹ ਸ਼ਾਦੀ ਮੇਲੇ ਨਾਚ ਗਾਉਣ ਦਾ ਬਹੁਤ ਹੀ ਭੰਗੜੇ ਦਾ ਪੂਰਨ ਮਹੱਤਤਾ ਹੈ ਇਸ ਕਰਕੇ ਭੰਗੜੇ ਦਾ ਬਹੁਤ ਹੀ ਪੰਜਾਬ ਵਿੱਚ ਸ਼ੁੱਧ ਪ੍ਰਸਾਰਣ ਰੱਖਿਆ ਜਾਂਦਾ ਹੈ